ਪੰਜਾਬ ਦੀ ਰਾਜਨੀਤਿਕ ਪ੍ਰਣਾਲੀ ਵਿੱਚ ਨਿਆਂ ਦੀ ਭੂਮਿਕਾ ਬਹੁਤ ਮਹੱਤਵਪੂਰਨ ਹੈ ਇਹ ਪ੍ਰਣਾਲੀ ਭਾਰਤੀ ਸੰਵਿਧਾਨ ਦੇ ਤਹਿਤ ਚਲਦੀ ਹੈ ਅਤੇ ਭਾਰਤੀ ਸੰਵਿਧਾਨ ਭਾ ਮਾਮਲਿਆਂ ਦੇ ਮੁਤਾਬਿਕ ਹੱਲ ਕਰਨ ਵਾਲਿਆਂ ਹ ਹੱਲ ਕਰਨ ਵਾਲੀ ਇੱਕ ਅਦਾਲਤ ਹੈ ਨਿਆਂਪਾਲਿਕਾ ਦੇ ਕੁਝ ਮੁੱਖ ਕਾਰਨ ਹਨ ਜਿਸ ਨਾਲ ਨਿਆਂਪਾਲਿਕਾ ਸੰਵਿਧਾਨ ਦੀ ਰੱਖਿਆ ਕਰਦੀ ਹੈ ਜੇ ਕਿਸੇ ਕਾਨੂੰਨ ਜਾਂ ਸਰਕਾਰੀ ਨੀਤੀ ਨੂੰ ਸੰਵਿਧਾਨ ਵਦੋ ਸੰਵਿਧਾਨ ਦੇ ਵਿਰੁੱਧ ਪਾਇਆ ਜਾਂਦਾ ਹੈ ਤਾਂ ਇਸ ਦੇ ਨਾਲ ਅਸੀਂ ਉਸਨੂੰ ਅਦਾਲਤ ਵਿੱਚ ਇਸ ਨੂੰ ਰੱਦ ਕਰ ਸਕਦੇ ਹਾਂ ਨਿਆਂਪਾਲਿਕਾ ਨਾਗਰਿਕਾਂ ਦੇ ਮੂਲ ਅਧਿਕਾਰਾਂ ਦੀ ਰੱਖਿਆ ਕਰਦੀ ਹੈ ਜਿਸ ਨਾਲ ਨਾਗਰਿਕਾਂ ਦੇ ਮੂਲ ਅਧਿਕਾਰ ਦੀ ਰੱਖਿਆ ਹੁੰਦੀ ਹੈ ਜੇ ਕਿਸੇ ਦੇ ਅਧਿਕਾਰਾਂ ਦੀ ਉਲੰਘਣਾ ਹੁੰਦੀ ਹੈ ਤਾਂ ਉਹ ਅਦਾਲਤ ਵਿੱਚ ਅਰਜ਼ੀ ਦਾਖਲ ਕਰ ਸਕਦਾ ਹੈ ਜਿਸ ਨਾਲ ਉਸ ਨੂੰ ਪੂਰਾ ਨਿਆਂ ਮਿਲਦਾ ਹੈ ਨਿਆਂਪਾਲਿਕਾ ਕਾਨੂੰਨਾਂ ਦੀ ਵਿਆਖਿਆ ਕਰਦੀ ਹੈ ਅਤੇ ਉਹਨਾਂ ਦੀ ਪਾਲਣਾ ਨੂੰ ਯਕੀਨੀ ਬਣਾਉਂਦੀ ਹੈ ਜੋ ਕਿ ਬਹੁਤ ਮਹੱਤਵਪੂਰਨ ਕੰਮ ਹੈ ਨਿਆਂਪਾਲਿਕਾ ਦਾ ਇਹ ਕਾਨੂੰਨਾਂ ਦੀ ਸਹੀ ਸਮਝ ਅਤੇ ਲਾਗੂ ਕਰਨ ਵਿੱਚ ਮਦਦ ਕਰਦੀ ਹੈ ਨਿਆਂਪਾਲਿਕਾ ਵਿਧਾਨ ਸ਼ਾਖਾਵਨ ਦਾ ਸੰਤੁਲਨ ਵੀ ਬਣਾਈ ਰੱਖਦੀ ਹੈ ਨਿਆਂਪਾਲਿਕਾ ਸਰਕਾਰ ਦੇ ਫੈਸਲੇ ਅਤੇ ਕਾਰਜਾਂ ਦੀ ਜਾਂਚ ਕਰਦੀ ਹੈ ਉਹ ਨਿਆਂਪਾਲਿਕਾ ਸਰਕਾਰ ਦੇ ਸਾਰੇ ਕੰਮਾਂ ਨੂੰ ਚੰਗੀ ਤਰ੍ਹਾਂ ਜਾਂਚ ਪਰਖ ਕੇ ਹੀ ਅੱਗੋਂ ਉਹਨਾਂ ਨੂੰ ਚਲਾਉਂਦੀ ਹੈ ਜੇ ਸਰਕਾਰ ਕੋਈ ਗਲਤ ਫੈਸਲਾ ਲੈ ਲੈਂਦੀ ਹੈ ਤਾਂ ਉਹ ਉਹਨਾਂ ਨੂੰ ਨਿਆਂਪਾਲਿਕਾ ਨਾਲ ਦੀ ਨਾਲ ਰੱਦ ਕਰ ਦਿੰਦੀ ਹੈ ਉਦਾਹਰਣ ਲਈ ਜੇ ਪੁਲਿਸ ਅਸ ਅਥਵਾ ਸਰਕਾਰੀ ਅਧਿਕਾਰ ਕਿਸੇ ਨੂੰ ਗਲਤ ਤਰੀਕੇ ਨਾਲ ਗ੍ਰਿਫਤਾਰ ਕਰਦੇ ਹਨ ਤਾਂ ਅਦਾਲਤ ਉਸਨੂੰ ਜ਼ਾਰੀ ਰੱਖਣ ਜਾਂ ਰੱਦ ਕਰਨ ਦਾ ਅਧਿਕਾਰ ਰੱਖਦੀ ਹੈ ਜਿਸ ਨਾਲ ਜੇ ਕੋਈ ਜੇ ਕਦੇ ਪੁਲਿਸ ਜਾਂ ਕੋਈ ਵੀ ਰਾਜਨੀਤਿਕ ਅਧਿਕਾਰੀ ਜਾਂ ਪੁਲਿਸ ਅਧਿਕਾਰੀ ਜੇ ਕਿਸੇ ਨੂੰ ਗਲਤੀ ਨਾਲ ਗ੍ਰਿਫਤਾਰ ਕਰ ਕਰ ਦਿ ਦਿੰਦਾ ਹੈ ਤਾਂ ਆਪਾਂ ਨਿਆਂਪਾਲਿਕਾ ਦੇ ਦੁਆਰਾ ਨਿਆਂ ਪ੍ਰਾਪਤ ਕਰ ਸਕਦੇ ਹਾਂ ਇਸੇ ਤਰੀਕੇ ਨਾਲ ਨਿਆਂਪਾਲਿਕਾ ਇਹ ਯਕੀਨ ਬਣਾਉਂਦੀ ਹੈ ਕਿ ਵਿਧਾਨਕ ਸਖਾਵਾਂ ਦੁਆਰਾ ਬਣਾਏ ਗਏ ਕਾਨੂੰਨ ਸੰਵਿਧਾਨ ਦੇ ਅਨੁਸਾਰ ਹਨ ਅਤੇ ਨਾਗਰਿਕਾਂ ਦੇ ਅਧਿਕਾਰਾਂ ਦੀ ਰੱਖਿਆ ਕਰਦੇ ਹਨ ਨਿਆਂਪਾਲਿਕਾ ਦੀ ਭੂਮਿਕਾ ਪੰਜਾਬ ਦੀ ਰਾਜਨੀਤੀ ਪ੍ਰਣਾਲੀ ਵਿੱਚ ਸੰਵਿਧਾਨ ਦਾ ਰਖਵਾਲ ਵਜ ਰਖਵਾਲ ਵੱਜੋਂ ਹੈ ਜੋ ਕਿ ਨਿਆਂਪਾਲਿਕਾ ਪੰਜਾਬ ਦੀ ਰਾਜਨੀਤੀ ਦੀ ਰੱਖਿਆ ਕਰਦੀ ਹੈ ਜੋ ਕਿ ਸਾਡੇ ਲਈ ਬਹੁਤ ਜ਼ਿਆਦਾ ਜ਼ਰੂਰੀ ਹੈ